ਮੈਂ ਫਲਿੱਪਕਾਰਟ 'ਤੇ ਸ਼ੋਪਿੰਗ ਕਰਦਾ ਹੀ ਰਹਿੰਦਾ ਪਰ ਕੁਝ ਕੁ ਦਿਨਾਂ ਤੋਂ ਮੈਂ ਸ਼ੋਪਿੰਗ ਨਹੀਂ ਕੀਤੀ ਅਤੇ ਨਾ ਹੀ ਮੈਂ ਫ੍ਰੀ ਸੀ ਬਾਕੀ ਹਲੇ ਮੇਰੇ ਕੋਲ ਪੈਸੇ ਵੀ ਨਹੀਂ ਸਨ ਪਰ ਕੱਲ੍ਹ ਮੈਂ ਜਦੋਂ ਆਪਣਾ ਕਾਰਟ ਦੇਖਿਆ ਤਾਂ ਉਹ ਫੁੱਲ ਹੋ ਚੁੱਕਾ ਸੀ ਮੈਂ ਜਦੋਂ ਵੀ ਐਪ ਖੋਲਦਾ ਹਾਂ ਮੈਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਆ ਮੈਂ ਉਹ ਕਾਰਟ ਵਿੱਚ ਸੇਵ ਕਰ ਲੈਂਦਾ ਵੀ ਜਦੋਂ ਮੇਰੇ ਕੋਲ ਪੈਸੇ ਹੋਣਗੇ ਮੈਂ ਲੈ ਲਵਾਂਗਾ ਪਰ ਕੱਲ੍ਹ ਜਦੋਂ ਮੈਂ ਦੇਖਿਆ ਤਾਂ ਕਾਰਟ ਫੁੱਲ ਹੋ ਚੁੱਕਾ ਸੀ ਮੈਂ ਸੋਚਦਾ ਹਾਂ ਇਸ ਵਿੱਚੋਂ ਕੁਝ ਚੀਜ਼ਾਂ ਹਟਾ ਦੇਵਾਂ ਕਾਰਟ ਵਿੱਚ ਮੈਂ ਕਈ ਚੀਜ਼ਾਂ ਸੇਵ ਕਰੀਆਂ ਹੋਈਆਂ ਹਨ ਜਿਵੇਂ ਬੂਟ ਹੈੱਡਫੋਨ ਮੋਬਾਇਲ ਫ਼ੋਨ ਜੈਕਟਾਂ ਪੈਂਟਾਂ ਅਤੇ ਹੋਰ ਵੀ ਕਈ ਚੀਜ਼ਾਂ ਮੈਂ ਸੋਚਦਾਂ ਇਹਨਾਂ ਵਿੱਚੋਂ ਜੋ ਚੀਜ਼ਾਂ ਮੇਰੇ ਕੋਲ ਹਨ ਮੈਂ ਉਹਨਾਂ ਨੂੰ ਹਟਾ ਦੇਵਾਂ ਜਿਵੇਂ ਹੈੱਡਫੋਨ ਮੋਬਾਇਲ ਪੈਂਟਾਂ ਬੂਟ ਐਨਕਾਂ ਆਦਿ ਜਿਹਨਾਂ ਦੀ ਹਜੇ ਮੈਨੂੰ ਜ਼ਰੂਰਤ ਨਹੀਂ ਬਾਕੀ ਮੇਰਾ ਭਰਾ ਵੀ ਐਪ ਯੂਜ ਕਰਦਾ ਹੀ ਰਹਿੰਦਾ ਹੈ ਮੈਂ ਜੋ ਉਹ ਜੋ ਵੀ ਚੀਜ਼ ਪਸੰਦ ਕਰਦਾ ਉਹ ਵੀ ਐਡ ਕਰ ਦਿੰਦਾ ਮੈਂ